ਮੈਂ ਮੋਹਾਲੀ ਜ਼ਿਲ੍ਹੇ ਤੋਂ ਵਸਨੀਕ ਹਾਂ ਸਾਡੇ ਵਿਆਹ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਸਾਡੇ ਵਿਆਹ ਤੋਂ ਪਹਿਲਾਂ ਆਪਣਾ ਪਾਠ ਰੱਖਿਆ ਜਾਂਦਾ ਹੈ ਅਤੇ ਮੇਲ ਵਾਲੇ ਦਿਨ ਜਾਗੋ ਕੱਢੀ ਜਾਂਦੀ ਹੈ ਜਾਗੋ ਕੱਢਣ ਡੀ ਜੇ ਲਗਾਏ ਜਾਂਦੇ ਹਨ ਅਤੇ ਸਾਰੇ ਬੜੀ ਧੂਮਧਾਮ ਨਾਲ ਨੱਚਦੇ ਹਨ ਆਪਣਾ ਨਾ ਨਾਨਕੇ ਨਾਨੀਆਂ ਘੋੜੀਆਂ ਆਪਣਾ ਗਾਉਂਦੀਆਂ ਹਨ ਅਤੇ ਅਤੇ ਆਪਣਾ ਨ ਜਦੋਂ ਨਵਾਂ ਬੱਚਾ ਜੰਮਦਾ ਹੈ ਸਾਡੇ ਪੰਜਾਬ ਦੇ ਵਿੱਚ ਤਾਂ ਆਪਣਾ ਗੁੜਤੀ ਦਿੱਤੀ ਜਾਂਦੀ ਹੈ ਗੁਰਦੁਆਰੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਉਸਦਾ ਉਨ੍ਹਾਂ ਦਾ ਨਾਮ ਧਰਨ ਕੀਤਾ ਜਾਂਦਾ ਹੈ ਪ੍ਰਥਾਵਾਂ ਦਾ ਰੀਤੀ ਰਿਵਾਜ਼ ਜ਼ਿਲ੍ਹੇ ਦੀ ਪਛਾਣ ਭਾਈਚਾਰੇ ਦੀ ਸਭ ਭਾਵਨਾਵਾਂ ਵਿੱਚ ਬਹੁਤ ਹੀ ਯੋਗਦਾਨ ਸਾਡੇ ਦਿਵਾਲੀ ਬਹੁਤ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਆਪਣਾ ਦੀਵਾ ਅਤੇ ਗੁਰਪੂਰਬ ਲੋਹੜੀ ਸ਼ਹੀਦੀ ਜੋੜ ਮੇਲੇ ਸਾਰੀ ਹੀ ਭਾਈਚਾਰਕ ਸਾਜਨਾਵਾਂ ਨਾਲ ਮਨਾਏ ਜਾਂਦੇ ਹਨ ਦਿਵਾਲੀ ਜਦੋਂ ਆਪਣਾ ਸ਼੍ਰੀ ਰਾਮ ਚੰਦਰ ਜੀ ਚੌਦ੍ਹਾਂ ਸਾਲਾਂ ਦਾ ਬਨਵਾਸ ਕੱਟ ਕੇ ਵਾਪਸ ਆਏ ਆਏ ਸਨ ਉਹਨਾਂ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਅਤੇ ਦਿਵਾਲੀ ਮਨਾਈ ਗਈ ਗੁਰਪੂਰਬ ਗੁਰਪੂਰਬ ਆਪਣਾ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਬਵੰਜਾ ਰਾਜਿਆਂ ਨੂੰ ਛਡਾ ਕੇ ਜਦੋਂ ਵਾਪਸ ਆਏ ਸਨ ਉਹਨਾਂ ਦੀ ਖੁਸ਼ੀ ਵਿੱਚ ਗੁ ਗੁਰਪੂਰਬ ਮਨਾਇਆ ਜਾਂਦਾ ਦੀਪਮਾਲਾ ਕੀਤੀ ਗਈ ਔਰ ਲੋਹੜੀ ਜਦੋਂ ਕੋਈ ਨਵਾਂ ਬੱਚਾ ਜੰਮਦਾ ਹੈ ਉਹਨਾਂ ਦੀ ਲੋਹੜੀ ਮਨਾਈ ਜਾਂਦੀ ਹੈ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਹਨ ਢੋਲ ਵਾਜਿਆਂ ਨਾਲ ਸਾਰੇ ਪਿੰਡ ਵਿੱਚ ਵਧਾਈ ਦਿੰਦੇ ਹਨ ਅਤੇ ਲੋਹੜੀ ਮਨਾਈ ਜਾਂਦੀ ਹੈ ਸ਼ਹੀਦੀ ਜੋੜ ਮੇਲਾ ਆਪਣਾ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਗ ਦ ਸਿੱਖਾਂ ਨੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਸ਼ ਸ਼ਹੀਦ ਹੋਏ ਸਨ ਉਹਨਾਂ ਦੀ ਸ਼ਹੀਦੀ ਦਿਹਾੜਾ ਸ਼੍ਰੀ